ਮੈਨੂੰ ਪੌਦੇ ਲਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਆਪਣੇ ਘਰ ਬਗੀਚੇ ਵਿੱਚ ਬਹੁਤ ਸਾਰੇ ਪੌਦੇ ਲਗਾਏ ਹੋਏ ਹਨ ਕਿਉਂਕਿ ਸਭ ਤੋਂ ਪਹਿਲਾਂ ਮੈਂ ਇਹ ਦੇਖਣਾ ਚਾਹੀਦਾ ਹੈ ਕਿ ਮਿੱਟੀ ਕਿਹੋ ਜਿਹੀ ਹੈ ਮਿੱਟੀ ਨਾ ਤਾਂ ਜ਼ਿਆਦਾ ਰੇਤਲੀ ਹੋਵੇ ਅਤੇ ਨਾ ਹੀ ਜ਼ਿਆਦਾ ਚੀਕਨੀ ਹੋਵੇ ਸਭ ਤੋਂ ਪਹਿਲਾਂ ਮੈਂ ਆਪਣੇ ਉੱਤੇ ਗਡਾਈ ਜ਼ਮੀਨ ਬਹੁਤ ਬਗੀਚੇ ਵਿੱਚ ਗਡਾਈ ਕੀਤੀ ਗਡਾਈ ਕਰਕੇ ਉਸ ਦੇ ਵਿੱਚ ਥੋੜ੍ਹੀ ਜਿਹੀ ਦੇਸੀ ਰੂੜੀ ਦੇ ਮਲਾਈ ਰੂੜੀ ਮਿਲਾ ਕੇ ਫਿਰ ਉਹਨੂੰ ਥੋੜ੍ਹਾ ਜਿਹਾ ਪਾਣੀ ਦਾ ਛਿੜਕਾਅ ਕੀਤਾ ਪਾਣੀ ਦਾ ਛਿਲਕਾਅ ਕਰਕੇ ਉਹਦੇ ਵਿੱਚ ਕੁਛ ਵੱਟਾਂ ਬਣਾ ਕੇ ਉਹਦੇ ਵਿੱਚ ਉੱਪਰ ਮੂਲੀਆਂ ਦੇ ਬੀਜ ਲਗਾ ਦਿੱਤੇ ਅਤੇ ਕਿਆਰੀਆਂ ਵਿੱਚ ਮੇਥੀ ਅਤੇ ਧਨੀਆ ਲਗਾ ਦਿੱਤਾ ਲਗਾ ਦਿੱਤਾ ਉਹ ਤੋਂ ਬਾਅਦ ਜਿਸ ਤਰਾਂ ਥੋੜ੍ਹਾ ਜਿਹਾ ਪਾਣੀ ਦਾ ਛਿੜਕਾਅ ਦੇ ਦਿੱਤਾ ਤਾਂ ਹਫਤੇ ਦਸ ਦਿਨਾਂ ਵਿੱਚ ਉਹ ਬੀਜ ਨਿਕਲ ਆਏ ਬੀਜ ਜੋ ਕਿ ਬਹੁਤ ਵਧੀਆ ਸਨ ਸਾਨੂੰ ਜ਼ਿਆਦਾ ਖਾਦਾਂ ਅਤੇ ਸਪਰੇਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਾਨੂੰ ਦੇਸੀ ਰੂੜੀ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਕਿ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਸਨ ਜਾਚ ਤਾਂ ਜੋ ਵਾਤਾਵਰਨ ਸੁਰੱਖਿਅਤ ਰਹਿ ਸਕੇ